ਸਕੂਲਾਂ ਵਿੱਚ ਬਾਕੀ ਸਿਲੇਬਸ ਦੇ ਨਾਲ ਨਾਲ ਕਰਜ਼ੇ ਅਤੇ ਰਿਟਰਨ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ ਕਿਉਂਕਿ ਸਕੂਲਾਂ ਵਿੱਚ ਜੋ ਸਿਲੇਬਸ ਚੱਲ ਰਿਹਾ ਹੈ ਉਸ ਦੀ ਜੀਵਨੀ ਵਿੱਚ ਖ਼ਾਸ ਜ਼ਰੂਰਤ ਨਹੀਂ ਪੈਂਦੀ ਇਹ ਪੜ੍ਹਾਈ ਦੇ ਸਭ ਕਿਤਾਬਾਂ ਵਿੱਚ ਹੀ ਰਹਿ ਜਾਂਦੀ ਹੈ ਸਾਨੂੰ ਰੋਜ਼ਮਰਾ ਦੀ ਜਿੰਦਗੀ ਵਿੱਚ ਜੋ ਚ ਚਲਦਾ ਹੈ ਸਾਨੂੰ ਸਕੂਲਾਂ ਵਿੱਚ ਸਿਖਾਉਣਾ ਚਾਹੀਦਾ ਹੈ ਕਰਜ਼ਾ ਤਾਂ ਹਰ ਇੱਕ ਨੂੰ ਲੈਣਾ ਹੀ ਪੈਂਦਾ ਹੈ ਇਸ ਲਈ ਕਰਜ਼ੇ ਅਤੇ ਰਿਟਰਨ ਬਾਰੇ ਸਾਨੂੰ ਸਕੂਲਾਂ ਵਿੱਚ ਪੂਰੀ ਜਾਣਕਾਰੀ ਦੇਣੀ ਚਾਹੀਦੀ ਹੈ